ਕੀ ਤੁਸੀਂ ਡਰਾਇੰਗ ਦਾ ਅਨੁਭਵ ਵਰਨਣ ਕਰ ਸਕਦੇ ਹੋ ਤੁਹਾਡੀ ਡਰਾਇੰਗ ਸ਼ੁਰੂ ਹੋਣ ਲਈ ਕਿਸ ਚੀਜ਼ ਦੇ ਪ੍ਰੇਰਿਤ ਕੀਤਾ ਗਿਆ ਡਰਾਇੰਗ ਇੱਕ ਬਹੁਤ ਵਧੀਆ ਕਲਾਕਾਰੀ ਹੈ ਜੋ ਕਿ ਬੰਦੇ ਨੂੰ ਪ੍ਰਭਾਵਿਤ ਅਤੇ ਖੁਸ਼ ਕਰਦੀ ਹੈ ਡਰਾਇੰਗ ਬਣਾਉਣ ਦੇ ਕਈ ਤਰੀਕੇ ਹਨ ਜਿਵੇਂ ਕਿ ਸਕੈਚਡ ਡਰੈਇੰਗ ਕਲਰ ਡਰੈਇੰਗ ਪੈਂਸਿਲ ਡਰਾਇੰਗ ਅਤੇ ਥ੍ਰੀ ਅਤੇ ਵਾਟਰ ਵਾਟਰ ਕਲਰ ਡਰਾਇੰਗ ਵਾਟਰ ਕਲਰ ਡਰਾਇੰਗ ਡਰਾਇੰਗ ਬਣਾਉਣ ਦੇ ਬੰਦੇ ਨੂੰ ਸ਼ੌਂਕ ਹੋਣਾ ਚਾਹੀਦਾ ਹੈ ਡਰਾਇੰਗ ਬਣਾਉਣ ਵੇਲੇ ਬੰਦੇ ਦਾ ਮਨ ਬਹੁਤ ਪ੍ਰਭਾਵਿਤ ਹੁੰਦਾ ਹੈ ਜਦੋਂ ਡਰਾਇੰਗ ਬਣਾ ਕੇ ਬੰਦਾ ਡਰਾਇੰਗ ਨੂੰ ਦੇਖਦਾ ਹੈ ਤਾਂ ਬਹੁਤ ਖੁਸ਼ ਹੁੰਦਾ ਹੈ ਅਤੇ ਉਹ ਆਪਣੀ ਕਲਾਕਾਰੀ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਤੇ ਜਦੋਂ ਉਹ ਦੂਸਰੇ ਬੰਦੇ ਨੂੰ ਡਰਾਇੰਗ ਬਣਾ ਕੇ ਦਿੰਦਾ ਹੈ ਤਾਂ ਉਹ ਦੂਸਰਾ ਬੰਦਾ ਵੀ ਬਹੁਤ ਖੁਸ਼ ਹੁੰਦਾ ਹੈ ਅਤੇ ਉਸ ਦੂਸਰੇ ਬੰਦੇ ਦੀ ਪ੍ਰਸ਼ੰਸਾ ਕਰਦਾ ਹੈ ਡਰਾਇੰਗ ਇੱਕ ਇੱਦਾਂ ਦੀ ਕਲਾਕਾਰੀ ਹੈ ਜੋ ਕਿ ਪੂਰੇ ਚਰਿਤਰ ਦੋ ਚਰਿੱਤਰ ਛਾਪ ਦਿੰਦੀ ਹੈ ਇਸ ਨਾਲ ਬੰਦੇ ਦੀ ਸ਼ਕਲ ਜਾਂ ਸੂਰਤ ਦੇਖਣ ਵਿੱਚ ਬਹੁਤ ਖੂਬਸੂਰਤ ਲੱਗਦੀ ਹੈ ਬੰਦਾ ਆਪਣੇ ਆਪ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੁੰਦਾ ਹੈ ਡਰਾਇੰਗ ਦੇ ਵਿੱਚ